ਮੈਂ ਡੋਮੀਨੋਜ ਦੀ ਐਪ ਡਾਊਨਲੋਡ ਕੀਤੀ ਹੋਈ ਸੀ ਮੈਂ ਉੱਥੇ ਨਾ ਇਹ ਵੇਖਦੀ ਰਹਿੰਦੀ ਸੀ ਕਿ ਪੀਜ਼ਾ ਦੀਆਂ ਔਫਰ ਕਿਹੜੀਆਂ ਕਿਹੜੀਆਂ ਆਉਂਦੀਆਂ ਨੇ ਅਤੇ ਉਹਨਾਂ ਦੇ ਬੇਸਿਸ 'ਤੇ ਕਿਉਂਕਿ ਮੈਨੂੰ ਪੀਜ਼ਾ ਬਹੁਤ ਪਸੰਦ ਹੈ ਆਟੋ ਪੇਮੈਂਟ ਲਗਾ ਦਿੱਤੀ ਪਰ ਹੁਣ ਮੇਰੇ ਨਾਲ ਕੁਛ ਚਲਾਕੀਆਂ ਹੁੰਦੀਆਂ ਪਈਆਂ ਨੇ ਅਤੇ ਮੈਂ ਔਡਰ ਕੀਤਾ ਵੀ ਨਹੀਂ ਅਤੇ ਆਪਣੇ ਆਪ ਪੈਸੇ ਮੇਰੇ ਕੱਟੇ ਜਾ ਰਹੇ ਨੇ ਅਤੇ ਮੈਂ ਦੋ ਤਿੰਨ ਦਿਨ ਇਸੇ ਤਰ੍ਹਾਂ ਮੇਰੇ ਨਾਲ ਹੋਇਆ ਮੈਂ ਹੁਣ ਆਟੋ ਪੇਮੈਂਟ ਦੀ ਉਮਸ਼ ਓਪਸ਼ਨ ਬੰਦ ਕਰਨ ਜਾ ਰਹੀ ਹਾਂ ਉਹਦੇ ਲਈ ਮੈਂ ਹੁਣ ਕੀ ਕੀਤਾ ਹੈ ਕਿ ਮੈਂ ਐਪ ਓਪਨ ਕੀਤੇ ਹੈ ਅਤੇ ਸੈਟਿੰਗ 'ਤੇ ਗਈ ਹਾਂ ਅਤੇ ਅਸੀਂ ਔਟੋ ਪੇਮੈਂਟ ਦੀ ਓਪਸ਼ਨ ਆਉਂਦੀ ਹੈ ਅਤੇ ਮੈਂ ਉਸ ਨੂੰ ਸਲਾਈਡ ਕਰਕੇ ਲੈਫਟ ਸਾਈਡ 'ਤੇ ਕਰਕੇ ਔਫ ਕਰ ਦਿੱਤੀਆਂ ਹਨ ਹੁਣ ਮੇਰੀ ਔਟੋ ਪੇਮੈਂਟ ਦੀ ਓਪਸ਼ਨ ਬੰਦ ਹੋ ਗਈ ਹੈ ਉਸ ਤੋਂ ਬਾਅਦ ਆਪਣੇ ਆਪ ਪੇਮੈਂਟ ਨਹੀਂ ਕੱਟੀ ਗਈ ਮੈਂ ਤਿੰਨ ਚਿਨ ਤਿੰਨ ਚਾਰ ਦਿਨ ਤੋਂ ਬਹੁ ਨੋਟਿਸ ਕੀਤਾ ਕਿ ਹੁਣ ਠੀਕ ਠਾਕ ਚੱਲ ਰਹੀ ਹੈ ਅਤੇ ਹੁਣ ਮੈਂ ਖੁਸ਼ ਹਾਂ ਮੈਂ ਦੁਬਾਰਾ ਤੋਂ ਉਸੇ ਐਪ ਵਾ ਅਤੇ ਔਡਰ ਕਰਕੇ ਪੇਮੈਂਟ ਕਰ ਰਹੀ ਹਾਂ ਤਾਂ ਜੋ ਮੇਰੇ ਨਾਜਾਇਜ਼ ਪੈਸੇ ਨਾ ਕੱਟੇ ਜਾਣ ਅਤੇ ਮੈਨੂੰ ਕਾਫ਼ੀ ਸਾਰੀਆਂ ਔਫਰਸ ਮਿਲ ਜਾਣਗੀਆਂ ਅਤੇ ਮੈਂ ਪੀਜ਼ਾ ਔਡਰ ਨਿਰੰਤਰ ਕਰ ਰਹੀ ਹਾਂ